ਹੈਲੋ ਹਾਂ ਕੀ ਹਾਲ ਵਧੀਆ ਵਧੀਆ ਤੂੰ ਸੁਣਾ ਹਾਂ ਬਸ ਤੂੰ ਤੂੰ ਦੇ ਸੁਜੈਸ਼ਨ ਹਮ ਹਮ ਹਾਂ ਹਾਂ ਹਾਂ ਉਹ ਤਾਂ ਉਹੀ ਆ ਹਮ ਹਮ ਹਾਂ ਯਾਰ ਜਾ ਕੇ ਹੀ ਪਤਾ ਲੱਗਣਾ ਕੋਈ ਨਾ ਕਰ ਲਾਂਗੇ ਜਾ ਕੇ ਹਮ ਚਲਣਾ ਇੱਕ ਦੋ ਦਿਨ ਤੱਕ ਹਮ ਹਮ ਹਾਂ ਹਾਂ ਹਾਂ ਕੋਈ ਨਹੀਂ ਦੋ ਦਿਨ ਤੱਕ ਫਿਰ ਚਲਦੇ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਸਕੂਟੀ 'ਤੇ ਚਲ ਬਾਕੀ ਵੇਖ ਲਾਂਗੇ ਹਾਂ ਹਮ ਹਾਂਜੀ ਹਾਂਜੀ ਹਾਂ ਠੀਕ ਹੈ ਹਾਂ ਹਾਂ ਠੀਕ ਹੈ ਓਕੇ